ਸਤਿ ਸ਼੍ਰੀ ਅਕਾਲ ਮੈਮ ਮੈਮ ਕੀ ਮੇਰੀ ਗੱਲ ਮੋਹਾਲੀ ਬੁੱਕ ਡਿਪੋਟ 'ਚ ਹੋ ਰਹੀ ਹੈ ਮੈਮ ਮੈਂ ਰੀਤੀਕਾ ਗੱਲ ਕਰ ਰਹੀ ਹਾਂ ਮੈਮ ਮੈਂ ਤੁਹਾਨੂੰ ਪੁੱਛਣਾ ਸੀ ਵੀ ਮੇਰੀ ਹੁਣੇ ਪਲੱਸ ਟੂ ਇੰਨਰੋਲ ਮੈਂ ਪਲੱਸ ਟੂ ਇੰਨਰੋਲ ਮੈਂ ਕੋਲੇਜ 'ਚ ਹੋਈ ਹਾਂ ਹੁਣੇ ਅਤੇ ਮੈਂ ਕੁਝ ਬੁੱਕਸ ਰਿਗਾਰਡਿੰਗ ਗੱਲ ਕਰਨੀ ਸੀ ਕੀ ਤੁਹਾਡੇ ਕੋਲ ਕਮਰਸ ਸ਼ੈਕਸ਼ਨ ਦੀ ਬੁੱਕਸ ਹੋਊਂਗੀ ਬੀ ਕੋਮ ਦੀ ਮੈਮ ਮੈਂ ਅਕਾਊਂਟਸ ਦੀ ਬੁੱਕ ਲੈਣੀ ਹੈ ਅਕਾਊਂਟਸ ਫਸਟ ਐਂਡ ਸੈਕਿੰਡ ਇੰਕਨੋਮਿਕਸ ਮੈਮ ਇੰਕਨੋਮਿਕਸ ਲੈਣੀ ਆ ਅਤੇ ਹੋਰ ਜਿਹੜੀ ਵੀ ਬੀ ਕੋਮ 'ਚ ਬੁੱਕਸ ਹੁੰਦੀਆਂ ਮੈਮ ਇੰਕਨੋਮਿਕਸ ਲੈਣੀ ਆ ਜੀ ਮੈਮ ਅਤੇਂ ਮੈਨੂੰ ਬਾਕੀ ਸਟੇਸ਼ਨਰੀ ਦਾ ਕੁਝ ਸਮਾਨ ਚਾਹੀਦਾ ਏ ਸਕੇਲ ਪੈਨਸਿਲ ਐਵਰੀਥਿੰਗ ਜੀ ਮੈਮ ਵਿਸਿਟ ਵਿਸਿਟ ਕਰੂਂਗੀ ਮੈਂ ਅਤੇ ਜੀ ਕਿਉਂਕਿ ਮੈਮ ਮੈਂ ਲੋਕਲ ਐਂ ਮੋਹਾਲੀ ਤੋਂ ਹੀ ਹਾਂ ਸੋ ਮੈਂ ਵਿਸਿਟ ਕਰੂਂਗੀ ਤੁਹਾਡੀ ਸ਼ਾਪ 'ਤੇ ਅਤੇ ਮੈਂ ਤੁਹਾਨੂੰ ਕਹਿਣਾ ਸੀ ਮੈਨੂੰ ਬਾਕੀ ਪੋਇਟਰੀਜ਼ ਪੜ੍ਹਨ ਦਾ ਵੀ ਸ਼ੌਂਕ ਹੈ ਉਹ ਵੀ ਤੁਹਾਡੇ ਕੋਲ਼ ਅਵੇਲੇਵਲ ਹੋਣਗੀਆਂ ਬੁੱਕਸ

ਮੈਮ ਮੈਂ ਇੰਗਲਿਸ਼ 'ਚ ਏ ਲੈਣੀ ਹੈ ਅਤੇ ਆਪਣੀ ਹਿਸਟਰੀ ਵਗੈਰਾ ਦੀ ਬੁੱਕਸ ਵੀ ਹੋਣਗੀਆਂ ਮੈਨੂੰ ਹਿਸਟਰੀ ਪੜ੍ਹਨ ਦਾ ਵੀ ਬਹੁਤ ਸ਼ੌਂਕ ਹੈ ਨਾ ਠੀਕ ਹੈ ਮੈਮ ਅਤੇ ਹੌਰ ਕੀ ਕੀ ਅਵੇਲੇਵਲ ਹੋਵੇਗਾ ਤੁਹਾਡੇ ਕੋਲ਼ ਜੀ ਮੈਮ ਜੀ ਜੀ ਓਕੇ ਮੈਮ ਅਤੇ ਆਪਣੇ ਕੋਲ਼ ਮੈਮ ਲੈਕਟਿਵ ਇੰਗਲਿਸ਼ ਦੀ ਬੁੱਕ ਹੋਵੇਗੀ ਅੱਛਾ ਜੀ ਹੋਰ ਆਪਣੇ ਕੋਲ਼ ਕੀ ਕੀ ਹੋਵੇਗਾ ਮੈਮ ਠੀਕ ਹੈ ਮੈਮ ਡਾਈਰੀਜ਼ ਵਗੈਰਾ ਅਤੇ ਆਪਣੀ ਜਿਵੇਂ ਕਾਰਡਜ਼ ਉਹ ਛੋਟੀ ਡਾਈਰੀਜ਼ ਹੁੰਦੀਆਂ ਹੈ ਅੱਛਾ ਜੀ ਜੀ ਠੀਕ ਹੈ ਮੈਮ ਦੈਨ ਫਿਰ ਮੈਂ ਤੁਹਾਡੀ ਸ਼ੋਪ 'ਤੇ ਵੀਜ਼ਿਟ ਕਰਾਂਗੀ ਥੈਂਕ ਯੂ ਸੋ ਮੱਚ ਓਕੇ ਮੈਮ